ਫਲਿੱਪਕਾਰਟ ਕਸਟਮਰ ਕੇਅਰ 'ਤੇ ਗੱਲ ਕਰ ਰਿਹਾਂ ਮੈਂ ਔਡਰ ਕੀਤਾ ਸੀ ਇੱਕ ਸ਼ਰਟ ਦਾ ਜਿਹੜੀ ਕਿ ਮੈਨੂੰ ਬਹੁਤ ਹੀ ਲੇਟ ਮਿਲੀ ਹੈ ਡਿਲੀਵਰੀ ਡੇਟ 'ਤੇ ਨਹੀਂ ਪਹੁੰਚੀ ਜੋ ਕਲਰ ਉਹਦਾ ਦਿਖਾਇਆ ਗਿਆ ਸੀ ਜੋ ਉਹਦੀ ਪਿਕਚਰ ਦਿਖਾਈ ਗਈ ਸੀ ਉਹ ਐਜ ਇਟ ਇਜ਼ ਨਹੀਂ ਹੈ ਜਦੋਂ ਮੈਂ ਉਹਨੂੰ ਓਪਨ ਕੀਤਾ ਸਾਈਜ਼ ਵੀ ਬਹੁਤ ਲੂਜ ਜ਼ਿਆਦਾ ਭੇਜ ਦਿੱਤਾ ਮੇਰਾ ਫ ਫਸਟ ਐਕਸਪੀਰੀਐਂਸ ਸੀ ਬਹੁਤ ਖ਼ਰਾਬ ਰਿਹਾ ਤੁਹਾਡੇ ਇਸ ਬ੍ਰੈਂਡ ਦੇ ਨਾਲ ਬਟਨ ਉਹਦੇ ਟੁੱਟੇ ਹੋਏ ਨੇ ਦੱਸੋ ਇਸ ਤਰ੍ਹਾਂ ਦੀ ਸ਼ਰਟ ਕੋਈ ਪਾਉਂਦਾ ਭਲਾ ਮੈਂ ਫੰਕਸ਼ਨ 'ਤੇ ਪਾਉਣੀ ਸੀ ਅਤੇ ਮੈਨੂੰ ਮਿਲੀ ਨਹੀਂ ਟਾਈਮ 'ਤੇ ਮੈਂ ਉਹ ਪਾ ਵੀ ਨਹੀਂ ਸਕਿਆ ਹੁਣ ਉਹ ਮੇਰੇ ਲਈ ਵੈਸੇ ਫਜ਼ੂਲ ਹੈ ਵੇਸਟ ਹੈ ਮੈਨੂੰ ਨਾ ਪੂਰੇ ਪੈਸੇ ਚਾਹੀਦੇ ਨੇ ਉਹਦੇ ਅਤੇ ਮੈਂ ਕੋਈ ਕਟਵਾਉਣਾ ਨਹੀਂ ਹੈ ਪੈਸਾ ਅਤੇ ਮੈਨੂੰ ਜਲਦ ਤੋਂ ਜਲਦ ਵਾਪਸ ਪੈਸੇ ਪੂਰੇ ਭੇਜ ਦਿੱਤੇ ਜਾਣ ਮੈਂ ਡੈਫੀਨੇਟਲੀ ਤੁਹਾਡਾ ਮਾੜਾ ਹੀ ਰਿਵਿਊ ਦਵਾਂਗਾ ਕੋਈ ਚੰਗਾ ਰਿਵਿਊ ਤਾਂ ਦਵਾਂਗਾ ਨਹੀਂ ਔਰ ਬਾਕੀਆਂ ਨੂੰ ਵੀ ਤੁਹਾਡਾ ਬ੍ਰੈਂਡ ਪ੍ਰੈਫਰ ਨਹੀਂ ਕਰਾਂਗਾ ਕਦੇ ਵੀ ਉਹਨਾਂ ਨੂੰ ਇਹ ਹੀ ਕਹਾਂਗਾ ਕਿ ਇਸ ਬ੍ਰੈਂਡ ਦੀ ਕੋਈ ਚੀਜ਼ ਨਹੀਂ ਖਰੀਦਣੀ ਸਹੀ ਤਾਂ ਹੈ ਨਹੀਂ ਅਤੇ ਫਿਰ ਆਪਾਂ ਲੈ ਕੇ ਕੀ ਕਰਨੀ ਪੈਸੇ ਵੀ ਜ਼ਿਆਦਾ ਲਗਾ ਰਹੇ ਹੋ ਤੁਸੀਂ ਬੈਟਰ ਇਹ ਹੀ ਰਹੇਗਾ ਕਿ ਅਸੀਂ ਕਿਸੇ ਹੋਰ ਬ੍ਰੈਂਡ ਨੂੰ ਪ੍ਰੈਫਰ ਕਰੀਏ ਤੁਸੀਂ ਮੇਰੇ ਪੈਸੇ ਰਿਫੰਡ ਕਰਦੋ ਬਹੁਤ ਹੀ ਅੱਛਾ ਰਹੇਗਾ ਥੈਂਕ ਯੂ ਧੰਨਵਾਦ